ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਜਿਹੜੀਆਂ ਇਹ ਆਮ ਤੌਰ 'ਤੇ ਦੇਖਿਆ ਗਿਆ ਕਿ ਜਦੋਂ ਚੋਣਾਂ ਦਾ ਸਮਾਂ ਆਉਂਦਾ ਉਦੋਂ ਫਿਰ ਜਨਤਾ ਨਾਲ ਵਾਅਦੇ ਬੜੇ ਬੜੇ ਕਰ ਜਾਂਦੇ ਆ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਵਾਅਦੇ ਕਰਦੇ ਨੇ ਕਿ ਇਹ ਕਰ ਦਿੱਤਾ ਜਾਏਗਾ ਇਹ ਸਹੂਲਤ ਦਿੱਤੀ ਜਾਏਗੀ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਉਹ ਵਾਅਦਿਆਂ ਦੇ ਪੂਰੀਆਂ ਉੱਤਰ ਦੀਆਂ ਨਹੀਂ ਆ ਬਾਕੀ ਇਹਨਾਂ ਦੇ ਅੰਦੋਲਨਾਂ ਦੀ ਤੇ ਬਾਰੇ ਗੱਲ ਕੀਤੀ ਜਾਏ ਤੇ ਜ਼ਿਆਦੀ ਆਪਾਂ ਨੂੰ ਇ ਇਹਨਾਂ ਦੀ ਸਿਆਸੀ ਪਾਰਟੀਆਂ ਦੇ ਅੰਦੋਲਨ ਦੀ ਜਾਣਕਾਰੀ ਕੋਈ ਸਾਨੂੰ ਜ਼ਿਆਦਾ ਨਹੀਂ ਹੈ ਅਤੇ ਨਾ ਹੀ ਅਸੀਂ ਮਤਲਬ ਕਿ ਇਹਨਾਂ ਸਿਆਸੀ ਮੁੱਦਿਆਂ ਦੇ ਬਾਰੇ ਕੋਈ ਜ਼ਿਆਦਾ ਵਿਚਾਰ ਕੀਤੀ ਹੈ ਜਾਂ ਮਤਲਬ ਕਿ ਸੋਚੀ ਦਾ ਸਾਨੂੰ ਇਹਨਾਂ ਦੇ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈ